ਜਦੋਂ ਕਿ ਅਸੀਂ ਹਸਪਤਾਲ ਦੇ ਵਿੱਚ ਜਾਂਦੇ ਹਾਂ ਤਾਂ ਉਥੋਂ ਦੇ ਜੋ ਪ੍ਰਬੰਧਕ ਹੈ ਬੜੇ ਟੈਮ ਟੈਮ ਸਿਰ ਬਹੁਤ ਵਧੀਆ ਸੰਭਾਲ ਅਤੇ ਪੁੱਛੋ ਦੱਸ ਹਰ ਜੋ ਕਿ ਜੇ ਕੋਈ ਮਤਲਬ ਟੈਸਟ ਬਾਰੇ ਜਾਂ ਕੋਈ ਮਤਲਬ ਜੇ ਅਲਟਰਾਸੌਨ ਏ ਜਾਂ ਕੋਈ ਟੈਸਟ ਕਰਾਉਣੇ ਹੈਂ ਜਾਂ ਕਿ ਕੋਈ ਵੀ ਲੋੜੀਂਦਾ ਸਟਾਫ਼ ਬਾਰੇ ਵੀ ਜਿਵੇਂ ਕਿ ਜ਼ਰੂਰਤ ਪੈਣ 'ਤੇ ਵੀ ਕਿਸੇ ਗੱਲੋਂ ਕਿਸੇ ਗੱਲ ਦਾ ਨਹੀਂ ਪਤਾ ਲੱਗਦਾ ਜੇ ਵਰ ਵੀ ਜਿ ਜੇ ਕਿਸੇ ਤੋਂ ਵੀ ਸਲਾਹ ਲੈਣੀ ਹੈ ਤਾਂ ਕਿਸੇ ਬਾਰੇ ਨਹੀਂ ਪਤਾ ਸਹੀ ਸਹੀ ਅਗਵਾਈ ਆਹਾ ਦੱਸ ਕੇ ਰਸਤਾ ਰਸਤੇ ਬਾਰੇ ਵੀ ਨਹੀਂ ਪਤਾ ਲੱਗਦਾ ਜਾਂ ਕਿਸੇ ਦੇ ਵੀ ਅਨਪੜ੍ਹ ਹੋਣ ਕਾਰਨ ਕਿਸੇ ਗੱਲ ਦਾ ਵੀ ਹਿਸਾਬ ਨਹੀਂ ਆਉਂਦਾ ਅਤੇ ਵਧੀਆ ਸਟਾਫ਼ ਹੈ ਜਿਸ ਕਿਸੇ ਨੇ ਪੁੱਛਣਾ ਸਾਰੇ ਸਲਾਹ ਵਧੀਆ ਦਿੰਦੇ ਨੇ ਹੋਰ ਕੀ ਜਦੋਂ ਜ਼ਰੂਰਤ ਪੈਣ 'ਤੇ ਡਾਕਟਰ ਦੀ ਜਾਂ ਹੈਲਪ ਦੀ ਜ਼ਰੂਰਤ ਪੈਂਦੀ ਹੈ ਤਾਂ ਵੀ ਬਹੁਤ ਵਧੀਆ ਨਾਲ ਜਾ ਕੇ ਦੱਸ ਕੇ ਸਾਰਾ ਕੁਛ ਸਹੀ ਸਮੇਂ 'ਤੇ ਬਹੁਤ ਵਧੀਆ ਦੱਸਦੇ ਹਨ ਅਤੇ ਬਹੁਤ ਹੀ ਵਧੀਆ ਅਤੇ ਵਧੀਆ ਤੋਂ ਵਧੀਆ ਸੰਭਾਲ ਕਰਦੇ ਹਨ ਨਾਲ ਜੋ ਕਿ ਜ਼ਰੂਰਤ ਪੈਣ 'ਤੇ ਕੋਈ ਚ ਹੀ ਜ਼ਰੂਰਤ ਹੁੰਦੀ ਹੈ ਤਾਂ ਵੀ ਉਹ ਵੀ ਜ਼ਰੂਰਤ ਪੂਰੀ ਕਰਦੇ ਨੇ ਜੇਕਰ ਕੋਈ ਦਵਾਈ ਦੀ ਨਾਲ ਜਾ ਕੇ ਦੱਸਣ ਦੀ ਜਾਂ ਕੋਈ ਹੋਰ ਹੈਲਪ ਦੀ ਲੋੜ ਹੁੰਦੀ ਹੈ ਉਹ ਵੀ ਬਹੁਤ ਵਧੀਆ ਖੱਸ ਕੇ ਅਤੇ ਦੱਸਦੇ ਹਨ ਅਤੇ ਸਾਰੇ ਸਲਾਹ ਵੀ ਬਹੁਤ ਵਧੀਆ ਅਤੇ ਚੰਗੀ ਹੀ ਦਿੰਦੇ ਹਨ ਇਸ ਕਰਕੇ ਜੇ ਪੇਸ਼ੈਂਟ ਨੂੰ ਚੰਗੀ ਤਰ੍ਹਾਂ ਬਹੁਤ ਵਧੀਆ ਹੀ ਖੁਸ਼ੀ ਮਿਲਦੀ ਹੈ ਅਤੇ ਵਧੀਆ ਹੈਲਪ ਨਾਲ ਪੇਸ਼ੈਂਟ ਨੂੰ ਹੈਲਪ ਮਿਲਦੀ ਹੈ ਅਤੇ ਇਸ ਕਾਰਨ ਬੜੀ ਨਾਲ ਨਾਲ ਖੁਸ਼ੀ ਵੀ ਬਹੁਤ ਚੰਗੀ ਅਤੇ ਵਧੀਆ ਹੀ ਮਿਲਦੀ ਹੈ ਇਸ ਕਾਰਕ ਪੇਸ਼ੈਂਟ ਬਹੁਤ ਖੁਸ਼ ਰਹਿੰਦੇ ਨੇ ਸਭ ਨੂੰ ਹੀ ਖੁਸ਼ੀ ਮਿਲਦੀ ਹੈ ਉਸ ਨਾਲ ਹੌਸਪੀਟਲ 'ਚ ਬਹੁਤ ਵਧੀਆ ਪ੍ਰਬੰਧਕ ਹਨ ਅਤੇ ਬਹੁਤ ਖੁਸ਼ੀ ਦੀ ਇਹ ਗੱਲ ਹੈ ਅਤੇ ਬਹੁਤ ਵਧੀਆ ਕੇਅਰ ਵੀ ਹੁੰਦੀ ਹੈ